ਜਦੋਂ ਮੈਂ ਪਹਿਲੀ ਵਾਰ ਕੁੱਝ ਬਣਾਉਣ ਬਾਰੇ ਸੋਚਿਆ ਤਾਂ ਮੈਂ ਸੋਚਿਆ ਆਲੂ ਗੋਭੀ ਉਹ ਮੈਂ ਸਿੱਖੀ ਹੈ ਯੂ ਟਿਊਬ ਤੋਂ ਉਹਨਾਂ ਨੇ ਮੈਨੂੰ ਕਿਵੇਂ ਦੱਸੀ ਕੁਛ ਇਸ ਤਰ੍ਹਾਂ ਪਹਿਲਾਂ ਸਬਜ਼ੀ ਕੱਟੀ ਕੱਟ ਕੇ ਲਸਣ ਪਿਆਜ ਉਹਨਾਂ ਨੇ ਕਿਆ ਕੱਟਿਆ ਉਹ ਵੀ ਕੱਟਿਆ ਫਿਰ ਗੈਸ ਆਨ ਕਰਕੇ ਉੱਪਰ ਕੜਾਹੀ ਧਰੀ ਤੇਲ ਪਾਇਆ ਵਿੱਚ ਉਹਦੇ ਲਸਣ ਅਦਰਕ ਪਿਆਜ ਪਾ ਕੇ ਉਹਨੂੰ ਅੱਛੀ ਤਰ੍ਹਾਂ ਫ਼ਰਾਈ ਕਰਕੇ ਫਿਰ ਨਮਕ ਹਲਦੀ ਮਿਰਚ ਪਾਈ ਉਸ ਤੋਂ ਬਾਅਦ ਉਹ ਦੇ ਵਿੱਚ ਆਲੂ ਅਤੇ ਗੋਭੀ ਪਾਈ ਉਹਨੂੰ ਘੱਟ ਕਰਕੇ ਗੈਸ ਨੂੰ ਉੱਪਰ ਤੋਂ ਪਲੇਟ ਦੇ ਕੇ ਢੱਕ ਤਾ ਅਤੇ ਉਹ ਤੋਂ ਥੋੜੀ ਦਸ ਕੁ ਮਿੰਟ ਬਾਅਦ ਜਦੋਂ ਉਹਨੂੰ ਦੇਖਿਆ ਤਾਂ ਗੋਭੀ ਮੇਰੀ ਬਣ ਕੇ ਤਿਆਰ ਸੀ ਧੰਨਵਾਦ ਯੂ ਟਿਊਬ ਦਾ